ਹੈਲੋ ਹਾਂਜੀ ਸਰਕਾਰੀ ਹਸਪਤਾਲ ਤੋਂ ਬੋਲ ਰਹੇ ਹੋ ਜੀ ਹਾਂਜੀ ਜੀ ਡਾਕਟਰ ਸਾਹਿਬ ਬੋਲ ਰਹੇ ਹੋ ਹਾਂਜੀ ਡਾਕਟਰ ਸਾਹਿਬ ਜੀ ਜੀ ਮੈਂ ਮੇਰੇ ਨਾ ਪੇਟ ਦਰਦ ਬਹੁਤ ਜ਼ਿਆਦਾ ਹੁੰਦਾ ਗਾ ਜੀ ਹਾਂਜੀ ਮੈਂ ਨਾ ਦਵਾਈ ਲੈਣ ਆਉਣਾ ਗਾ ਅਤੇ ਤੁਸੀਂ ਅਸੀਂ ਬੁਲਾਢੇ ਤੋਂ ਬੋਲ ਰਹੇ ਹਾਂ ਜੀ ਹਾਂਜੀ ਮੈਂ ਪਹਿਲਾਂ ਬੁਲਾਢੇ ਤੋਂ ਵੀ ਦਵਾਈ ਲਿੱਤੀ ਸੀ ਜਾ ਮੈਨੂੰ ਕੁਛ ਫ਼ਰਕ ਨਹੀਂ ਪਿਆ ਹੈਗਾ ਹਾਂਜੀ ਜੀ ਮੇਰੇ ਨਾ ਪੇਟ 'ਚ ਸੋਜ ਹੈ ਜੀ ਸੋਜ ਕਰਕੇ ਵੀ ਪ੍ਰੇਸ਼ਾਨੀ ਹੁੰਦੀ ਮੈਨੂੰ ਦਰਦ ਹੁੰਦਾ ਮੇਰੇ ਸੋਜ ਨਹੀਂ ਘੱਟ ਰਹੀ ਜੀ ਪੇਟ 'ਚ ਸੋਜਾ ਆ ਜਾਂਦਾ ਗਾ ਜੀ ਪਹਿਲਾਂ ਵੀ ਮੈਂ ਬੁਲਾਢੇ ਤੋਂ ਲਿੱਤੀ ਸੀ ਦਵਾਈ ਮੈਨੂੰ ਫ਼ਰਕ ਨਹੀਂ ਪਿਆ ਹੈਗਾ ਜੀ ਹਾਂਜੀ ਹਾਂਜੀ ਟੈਸਟ ਕਰਵਾਇਆ ਸੀ ਜੀ ਉਹਦੇ ਵਿੱਚ ਥੋੜ੍ਹੀ ਸੋਜ ਜਿਹੀ ਆਈ ਸੀ ਜੀ ਕੁਛ ਕਮਜ਼ੋਰੀ ਜੀ ਵੀ ਬਹੁਤ ਮਹਿਸੂਸ ਹੁੰਦੀ ਹੈ ਵੈਸੇ ਜਦੋਂ ਮੈਂ ਕੰਮ ਕਰਦੀ ਹਾਂ ਵੀ ਨਾ ਚੱਕਰ ਆਉਣ ਲੱਗ ਜਾਂਦੇ ਨੇ ਹਾਂਜੀ ਹੁਣ ਜੀ ਹਾਂਜੀ ਤੁਹਾਡੇ ਹਸਪਤਾਲ ਬਾਰੇ ਜੀ ਮੈਂ ਵੀ ਕਿਸੇ ਤੋਂ ਜਾਣਕਾਰੀ ਦਿੱਤੀ ਸੀ ਮੈਨੂੰ ਕਿਸੇ ਨੇ ਕਹਿੰਦੇ ਉੱਥੇ ਵੀ ਦਵਾਈ ਵਧੀਆ ਮਿਲਦੀ ਵਈ ਡਾਕਟਰ ਵਧੀਆ ਨੇ ਜੀ ਹਾਂਜੀ ਨਾ ਜੀ ਕਰਵਾਇਆ ਨਹੀਂ ਜੀ ਹੈਗਾ ਸਿਰ ਦਾ ਨਹੀਂ ਜੀ ਕਰਵਾਇਆ ਹੈਗਾ ਹਾਂਜੀ ਠੀਕ ਹੈ ਜੀ ਅੱਛਾ ਜੀ ਡਾਕਟਰ ਦੀ ਫੀਸ ਕਿੰਨੀ ਹੈ ਜੀ

ਅੱਛਾ ਜੀ ਫਿਰ ਜੀ ਦਵਾਈ ਅੰਦਰੋਂ ਮਿਲਦੀ ਹੈ ਜੀ ਕੇ ਬਾਹਰੋਂ ਮਿਲਦੀ ਹੈ ਜੀ ਅੱਛਾ ਜੀ ਜੀ ਮੈਨੂੰ ਹਾਂਜੀ ਪਹਿਲਾਂ ਮੈਂ ਭਿੱਖੀ ਤੋਂ ਲਿੱਤੀ ਸੀ ਦਵਾਈ ਸਰਕਾਰੀ ਚੋਂ ਮੈਂ ਬੋਤਲਾਂ ਵੀ ਬੋਤਲ ਲਵਾਈਆਂ ਸੀ ਮੈਨੂੰ ਕੋਈ ਫ਼ਾਇਦਾ ਨਹੀਂ ਹੋਇਆ ਹੈਗਾ ਨਾ ਬੋਤਲਾਂ ਦਾ ਕੋਈ ਅਸਰ ਹੋਇਆ ਦੋ ਕੁ ਦਿਨ ਬਸ ਅਸਰ ਜਿਹਾ ਹੋਇਆ ਸੀ ਮੁੜਕੇ ਫਿਰ ਓਵੇਂ ਹੀ ਹੋ ਗਈ ਸੀ ਜਿੰਨਾ ਚਿਰ ਦਵਾਈ ਖਾਈ ਜਾਂਦੀ ਹਾਂ ਬਸ ਠੀਕ ਰਹਿੰਦੀ ਹਾਂ ਜਦੋਂ ਬੰਦ ਕਰ ਦਿੰਦੀ ਹਾਂ ਦਵਾਈ ਫਿਰ ਓਵੀਂ ਸਰੀਰ ਹੋ ਜਾਂਦਾ ਗਾ ਕਮਜ਼ੋਰੀ ਮਹਿਸੂਸ ਠੀਕ ਹੈ ਜੀ ਅੱਛਾ ਜੀ ਧੰਨਵਾਦ ਜੀ